ਹਾਂਜੀ ਅੰਕਲ ਜੀ ਪੈਰੀਂ ਪੈਂਨੇ ਜੀ ਬਸ ਠੀਕ ਹੈ ਤੁਸੀਂ ਸੁਣਾਓ ਕਿੱਦਾਂ ਹਾਲ ਠੀਕ ਹੈ ਜੀ ਬਸ ਠੀਕ ਹੈ ਤੁਸੀਂ ਟੱਕਰਦੇ ਮਿਲਦੇ ਨਹੀਂ ਕਿਆ ਕਰੀਏ ਅੰਕਲ ਜੀ ਹੁਣ ਕੰਮ ਕੁੰਮ ਕਰਕੇ ਬਸ ਠੀਕ ਹੈ ਕੰਨਸਟਰਕਸ਼ਨ ਦਾ ਠੀਕ ਚੱਲਦਾ ਜੀ ਹੁਣ ਉ ਬਸ ਥੋੜ੍ਹੀ ਪਹਿਲਾਂ ਦਿੱਕਤ ਸੀਗੀ ਪਹਿਲਾਂ ਥੋੜ੍ਹੀ ਦਿੱਕਤ ਜਿਹੀ ਸੀਗੀ ਥੋੜ੍ਹੀ ਸਮਾਨ ਸਮੂਨ ਨਹੀਂ ਮਿਲਦਾ ਸੀਗਾ ਹਾਂਜੀ ਉ ਕੰਨਸਟਰਕਸ਼ਨ ਦਾ ਸਮਾਨ ਏ ਉਹ ਹੁਣ ਅੰਕਲ ਜੀ ਜਾ ਕੇ ਮਿਲਣ ਲੱਗਾ ਪਹਿਲਾਂ ਥੋੜ੍ਹਾ ਰੇਤਾ ਮਾਨਿੰਗ ਕਰਕੇ ਬੰਦ ਹੋਇਆ ਸੀਗਾ ਹਾਂਜੀ ਅਤੇ ਸਰੀਆ ਸੁਰੀਆ ਵੀ ਚੱਲੋ ਹੁਣ ਠੀਕ ਆਉਣ ਲੱਗ ਗਿਆ ਪਹਿਲਾਂ ਸੀਮਿੰਟ ਦੀ ਕੋਆਲਟੀ ਨਹੀਂ ਸਹੀ ਆਉਂਦੀ ਸੀ ਹਾਂਜੀ ਸੀਮਿੰਟ ਹੁਣ ਵਧੀਆ ਮਿਲਣ ਲੱਗ ਗਿਆ ਸਗੋ ਤਿੰਨ ਸੌ ਅੱਸੀ ਅੱਸੀ ਹਾਂਜੀ ਹਾਂਜੀ ਲੇਬਰ ਬਸ ਠੀਕ ਹੈ ਤਿੰਨ ਸੌ ਅੱਸੀ ਦਾ ਭਾਅ ਮਿਲਿਆ ਸੀਮਿੰਟ ਜੇ ਕੇ ਲਕਸ਼ਮੀ ਜੀ ਹਾਂ ਸਰੀਆ ਵੀ ਉੱਥੋਂ ਲੈ ਲਿਆ ਵਿਜੇ ਤੋਂ ਇੱਟ ਅੰਕਲ ਜੀ ਮਿਲੀ ਸੀਗੀ ਛੇ ਹਜ਼ਾਰ ਰੁਪਏ ਨੂੰ ਆ ਜੀ ਹਾਂਜੀ ਉਹ ਹੀ ਪੈਂਹਠ ਪੈਂਹਠ ਪੈਂਹਠ ਸੌ ਸੱਤ ਹਜ਼ਾਰ ਦੇ ਨੇੜੇ ਆ ਹਾਂਜੀ ਬਸ ਦੇਖੋ ਹੁਣ ਕੰਮ ਚੱਲਦਾ ਤਾਂ ਜੀ ਕੰਮ ਚੱਲਦਾ ਪਿਆ ਬਸ ਦੇਖੋ ਆਹ ਦੋ ਤਿੰਨ ਮਹੀਨੇ ਤੱਕ ਹੋ ਜਾਣਾ ਕੰਮ ਖ਼ਤਮ ਸਾਰਾ ਦੋ ਦੋ ਮਹੀਨੇ ਰਹਿ ਗਏ ਸਾ ਸਾਲ ਹੋ ਗਿਆ ਬਸ ਦੋ ਹਾਂਜੀ ਦੋ ਮਹੀਨੇ ਰਹਿ ਗਏ ਬਸ ਹਾਂਜੀ ਹਾਂਜੀ ਹਾਂਜੀ ਤੁਸੀਂ ਦੱਸੋ ਤੁਸੀਂ ਕਦੋਂ ਰੈਨੋਵੇਸ਼ਨ ਸ਼ੁਰੂ ਕਰਾਂਣਗੇ ਘਰ ਦੀ ਚੱਲੋ ਦੱਸਿਓ ਫਿਰ ਮੈਨੂੰ ਕੋਈ ਨਹੀਂ ਮੈ ਦੱਸ ਦਿਓ ਕੋਈ ਕੋਈ ਨਹੀਂ ਚੱਲੋ ਠੀਕ ਹੈ ਅੰਕਲ ਜੀ ਮੈਂ ਤੁਹਾਨੂੰ ਟੱਕਰਦਾ ਜੀ ਮਿਲਦਾ ਫਿਰ ਤੁਹਾਨੂੰ ਮੈਂ ਓਕੇ ਓਕੇ ਓਕੇ ਓਕੇ ਜੀ